ਸਾਡੇ ਖੇਤਰਾਂ ਦੇ ਲੋਕਾਂ ਲਈ ਮਾਨਸਿਕ ਸਿਹਤ ਅਤੇ ਸਮੁੱਚੀ ਤੰਦਰੁਸਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖੇਡ ਖੇਤਰ ਦੁਆਰਾ ਬਹੁਤ ਸਾਰੇ ਹੀ ਪ੍ਰੋਗਰਾਮ ਚਲਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਬੱਚਿਆਂ ਬਜ਼ੁਰਗਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਸਕੇ ਅਤੇ ਨਾਲ਼ ਹੀ ਮਨੋਰੰਜਨ ਦਾ ਸਾਧਨ ਬਣ ਸਕਣ ਜਿਵੇਂ ਕਿ ਮੇਲੇ ਧਾਰਮਿਕ ਤਿਉਹਾਰਾਂ ਮੇਲਿਆਂ 'ਤੇ ਕਬੱਡੀਆਂ ਛਿੰਝਾਂ ਕਰਵਾਈਆਂ ਜਾਂਦੀਆਂ ਹਨ ਕਬੱਡੀ ਕਰਵਾਈ ਜਾਂਦੀ ਹੈ ਜਿਹਦੇ ਵਿੱਚ ਨੌਜਵਾਨ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਂਦੇ ਹਨ ਇਸ ਤੋਂ ਇਲਾਵਾ ਨੌਜਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ ਤਾਂ ਜੋ ਇਹ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਤੰਦਰੁਸਤੀ ਦਾ ਸਾਧਨ ਹਨ ਇਸ ਦੇ ਨਾਲ਼ ਵਿਅਕਤੀ ਤੰਦਰੁਸਤ ਰਹਿੰਦਾ ਹੈ ਇਸ ਤੋਂ ਇਲਾਵਾ ਹੋਰ ਕਈ ਛੋਟੇ ਮੋਟੇ ਖੇਡ ਖੇਤਰਾਂ ਵਿੱਚ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਸ ਵਿੱਚ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਹੋ ਸਕੇ ਤਾਂ ਜੋ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਨਸ਼ਿਆਂ ਦੇ ਨਾਲ਼ ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਹੀ ਧੱਕਾ ਲੱਗਾ ਹੋਇਆ ਹੈ ਖੇਡ ਖੇਤਰ ਬਹੁਤ ਹੀ ਵਧੀਆ ਕਾਰਜ ਕਰ ਰਹੀ ਹੈ ਤਾਂ ਜੋ ਇਹਨਾਂ ਤੋਂ ਬਚਾਇਆ ਜਾ ਸਕੇ ਕਬੱਡੀ ਛਿੰਝ ਆਦਿ ਕਰਵਾਏ ਜਾ ਰਹੇ ਹਨ ਹੋਰ ਕਈ ਛੋਟੇ ਮੋਟੇ ਮੁਕਾਬਲੇ ਕਰਵਾਏ ਜਾਂਦੇ ਹਨ